ਹਾਂਜੀ ਨਮਸਕਾਰ ਜੀ ਹਾਂਜੀ ਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਕਿਹੜੇ ਕਿਹੜੇ ਚਾਹੀਦੇ ਨੇ ਠੀਕ ਹੈ ਜੀ ਤੁਹਾਨੂੰ ਮਤਲਬ ਕੀ ਕਿੰਨੇ ਕਿੰਨੇ ਕਿਲੋ ਵਾਲੇ ਚਾਹੀਦੇ ਨੇ ਬ ਪਹਿਲਾਂ ਤਾਂ ਮੈਨੂੰ ਟੋਪ ਦਾ ਦੱਸ ਦਿਓ ਆਈਡੀਆ ਕਿੰਨੇ ਕਿਲੋ ਵਾਲੇ ਚਾਹੀਦੇ ਨੇ ਦਸ ਕਿਲੋ ਦਸ ਦਸ ਕਿਲੋ ਵਾਲੇ ਚਾਰ ਲੈਣੇ ਨੇ ਠੀਕ ਹੈ ਜੀ ਮੈਂ ਉਹ ਵੀ ਕਢਵਾ ਕੇ ਰੱਖ ਦਾਂਗੀ ਨਹੀ ਜੀ ਤੁਸੀਂ ਕਿੰਨੇ ਕਿਲੋ ਦੀ ਕੋਈ ਪੰਜੀਰੀ ਪਿੰਨੀਆਂ ਵਗੈਰਾ ਉਹੀ ਚੀਜ਼ ਬਣਾਉਣੀ ਹੈ ਜਾਂ ਪੂਰੀਆਂ ਵਗੈਰਾ ਤਲਨੀਆਂ ਨੇ ਹਾਂਜੀ ਠੀਕ ਹੈ ਜੀ ਤੁਹਾਨੂੰ ਕਿੰਨੀਆਂ ਕੁ ਚਾਹੀਦੀਆਂ ਕੜਾਹੀਆਂ ਮੈਂ ਉੰਨੇ ਦਾ ਇੰਤਜਾਮ ਕਰਕੇ ਰੱਖਾਂ ਨਾ ਓਕੇ ਠੀਕ ਹੈ ਜੀ ਅਤੇ ਪਤੀਲੇ ਨਾ ਤੁਹਾਨੂੰ ਗੋਲ ਵਿੱਚ ਵੀ ਆਉਂਦੇ ਨੇ ਅਤੇ ਵੱਡੇ ਵੱਡੇ ਦੂਸਰੇ ਨਵੇਂ ਡਿਜ਼ਾਇਨ ਵੀ ਆ ਗਏ ਨੇ ਅਤੇ ਤੁਸੀਂ ਠੀਕ ਹੈ ਜੀ ਸਿਲਵਰ ਵਾਲੇ ਮੰਗਵਾ ਦਾਂਗੇ ਹਾਂਜੀ ਹਾਂਜੀ ਮਿਲ ਜਾਣਗੇ ਜੀ ਤੁਹਾਨੂੰ ਕਦੋਂ ਤੱਕ ਚਾਹੀਦੇ ਨੇ ਮੈਨੂੰ ਇਹ ਦੱਸ ਦਿਓ ਆਈਡੀਆ ਮੈਂ ਉਦੋਂ ਤੱਕ ਤੁਹਾਡਾ ਸਮਾਨ ਸਾਰਾ ਕਲੈਕਟ ਕਰਕੇ ਰੱਖਾਂਗੀ ਨਾ ਤੁਸੀਂ ਆਓਗੇ ਪਰਸੋਂਂ ਤੱਕ ਚਾਹੀਦੇ ਨੇ ਕੋਈ ਗੱਲ ਨਹੀਂ ਕੱਲ੍ਹ ਮੈਂ ਸਾਰੇ ਫੋਨ ਕਰਕੇ ਨਾ ਆਪਣੇ ਗਡਾਊਨ 'ਚੋਂ ਕਢਵਾ ਲਾਂਗੀ ਅਤੇ ਤੁਸੀਂ ਪਰਸੋਂ ਆ ਜਾਣਾ ਪਰਸੋਂ ਆਕੇ ਤੁਸੀਂ ਦੇਖ ਲੈਣਾ ਸਾਡੇ ਕੋਲ ਬਹੁਤ ਹੀ ਸੋਹਣੀ ਸੋਹਣੀ ਬਹੁਤ ਵਰਾਇਟੀ ਹੈਗੀ ਹੈ ਟੋਪ ਦੀ ਵੀ ਨੇ ਕੜਾਹੀਆਂ ਦੀ ਵੀ ਨੇ ਵੱਡੇ ਵੱਡੇ ਸਾਰੇ ਬਰਤਨਾਂ ਦੀ ਹੈਗੀਆਂ ਨੇ ਅਤੇ ਕੋਈ ਗੋਲ ਵਿੱਚ ਹੈ ਕੋਈ ਚੋਰਸ ਵਿੱਚ ਹੈ ਅਤੇ ਡਿਜ਼ਾਇਨ ਕੋਈ ਹੈਵੀ ਵਿੱਚ ਵੀ ਹੈ ਲਾਈਟ ਵਿੱਚ ਵੀ ਹੈ ਇਹ ਤਾਂ ਤੁਹਾਨੂੰ ਦੇਖਿਆਂ ਹੀ ਪਤਾ ਲੱਗਣੇ ਨੇ ਹਾਂਜੀ ਹਾਂਜੀ ਮੈਨੂੰ ਵੀ ਚੀਜ਼ ਨਹੀਂ ਲੱਗਦੀ ਉਹਨਾਂ ਦੀ ਥੱਲੇ ਕੋਈ ਚੀਜ਼ ਨਹੀਂ ਲੱਗੇਗੀ ਨਾ ਤੁਹਾਨੂੰ ਕੋਈ ਦੁੱਧ ਵਾਲਾ ਦਵਾਨ ਹੈ ਤਾਂ ਵੀ ਕੋਈ ਸਮੈਲ ਨਹੀਂ ਆਵੇਗੀ ਸੜਦਾ ਨਹੀਂ ਹੋਵੇਗਾ ਨਾ ਤੁਹਾਨੂੰ ਹਿਲਾਉਣਾ ਪਵੇਗਾ ਆਪਣੇ ਆਪ ਹੀ ਅੱਜ ਕੱਲ੍ਹ ਤਾਂ ਵਧੀਆ ਹੀ ਆਉਂਦੇ ਨੇ ਬਰਤਨ ਵੈਸੇ ਤਾਂ ਸਾਡੇ ਰੇਟ ਤਾਂ ਬਹੁਤ ਜ਼ਿਆਦਾ ਨੇ ਕੋਈ ਗੱਲ ਨਹੀਂ ਤੁਸੀਂ ਆਓਗੇ ਨਾ ਮੈਂ ਬੈਠ ਕੇ ਸਾਰਾ ਹਿਸਾਬ ਲਗਾ ਦਾਂਗੇ ਵੈਸੇ ਤਾਂ ਜਿਹੜਾ ਇੱਕ ਬਰਤਨ ਤੁਹਾਡਾ ਬਣੇਗਾ ਇੱਕ ਟੋਪ ਕੋਈ ਹਜ਼ਾਰ ਬਾਰਾਂ ਸੌ ਦੇ ਨੀਅਰ ਅਬਾਊਟ ਉਸ ਅਕੋਰਡਿੰਗ ਤੁਹਾਡਾ ਆ ਜਾਵੇਗਾ ਪੰਦਰਾਂ ਪੰਦਰਾਂ ਕੁ ਹਜ਼ਾਰ ਦੇ ਨੀਅਰ ਅਬਾਊਟ ਤੁਹਾਡਾ ਬਣ ਜਾਵੇਗਾ ਸਾਰਾ ਸਮਾਨ ਕੱਲ੍ਹ ਨਹੀਂ ਨਾ ਪਰਸੋਂ ਆਉਣਾ ਤੁਸੀਂ ਤਾਂ ਮੈਨੂੰ ਪਰਸੋਂ ਕਹਿ ਰਹੇ ਸੀ ਅਤੇ ਕੱਲ੍ਹ ਮੈਂ ਸਾਰਾ ਗਡਾਊਨ 'ਚੋਂ ਕਢਵਾਉਣਾ ਠੀਕ ਆ ਠੀਕ ਆ ਸੈਂਪਲ ਦੇਖਣ ਆਓਗੇ ਹਾਂਜੀ ਹਾਂਜੀ ਫਿਰ ਮੈਂ ਤੁਹਾਨੂੰ ਹੋਰ ਇੰਤਜਾਮ ਕਰਵਾ ਦਾਂਗੀਗੀ ਕੋਈ ਨਹੀਂ ਵੈਸੇ ਆਪਣੇ ਕੋਲ ਸਾਰੇ ਮਟੀਰੀਅਲ ਹੀ ਪਏ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਾ ਕੁਛ ਪਿਆ ਨਹੀਂ ਜੀ ਨਹੀਂ ਜੀ ਨਹੀਂ ਤੁਸੀਂ ਕੱਲ੍ਹ ਸ਼ਾਮ ਤੱਕ ਆ ਜਾਣਾ ਮੈਂ ਸਾਰਾ ਤੁਹਾਨੂੰ ਦਿਖਾ ਦਾਂਗੀ ਹਾਂਜੀ ਜ਼ਰੂਰ ਜੀ ਜ਼ਰੂਰ ਇੱਕ ਵਾਰ ਮੈਨੂੰ ਫੋਨ ਵੀ ਜ਼ਰੂਰ ਕਰ ਲੈਣਾ ਆਉਣ ਤੋਂ ਪਹਿਲਾਂ ਕਈ ਵਾਰ ਘਰ ਖਾਣਾ ਖਾ ਵਗੈਰਾ ਖਾਣ ਨਾ ਗਏ ਹੋਣ ਨਾ ਲੜਕੇ ਠੀਕ ਹੈ ਜੀ ਠੀਕ ਹੈ ਜੀ ਓਕੇ